ਸਤਿ ਸ਼੍ਰੀ ਅਕਾਲ ਜੀ ਪ੍ਰੀਤਮ ਸਿੰਘ ਬੋਲਦੇ ਜੀ ਕੈਬ ਡਰਾਈਵਰ ਮੈਂ ਤੁਹਡੀ ਟੈਕਸੀ ਬੁੱਕ ਕਰਨਾ ਚਾਹੁੰਦਾ ਹਾਂ ਮੈਂ ਆਪਣੇ ਦੋਸਤਾਂ ਨਾਲ ਜਾਣਾ ਚਾਹੁੰਦਾ ਹਾਂ ਯਾਤਰਾ 'ਤੇ ਇਹ ਯਾਤਰਾ ਸਾਡੀ ਤੁਸੀਂ ਇੱਕ ਇੱਕ ਹਫ਼ਤੇ ਦੀ ਹੋਵੇਗੀ ਤੁਸੀਂ ਪ੍ਰਤੀ ਕਿਲੋਮੀਟਰ ਕਿੰਨੇ ਰੁਪਈਏ ਲੈਂਦਾ ਲੈਂਦੇ ਹੋ ਇਸ ਬਾਰੇ ਸਾਨੂੰ ਦੱਸਿਓ ਅਸੀਂ ਸ਼ਿਮਲੇ ਤੋਂ ਕੁਫਰੀ ਕੁਫਰੀ ਤੋਂ ਹੋਰ ਦੇਖਾਂਗੇ ਜੇ ਕਿਤੇ ਸਮਾਂ ਲੱਗਿਆ ਤਾਂ ਹੋਰ ਜਗ੍ਹਾ ਵੀ ਜਾਵਾਂਗੇ ਇਹ ਜਣੀ ਕਿ ਆਪਾਂ ਨੇ ਹਫ਼ਤੇ ਵਿੱਚ ਨਿਬੇੜ ਦੇਣਾ ਫਿਰ ਸਾਨੂੰ ਦੱਸ ਦਿਓ ਧੰਨਵਾਦ